ਇੰਟਰਨੈਟ ਨੇ ਮੇਰੇ ਲਈ ਬਹੁਤ ਮਦਦਗਾਰ ਸਾਬਿਤ ਹੋਇਆ ਹੈ ਕਿਉਂਕਿ ਇਹ ਦੁਨੀਆਂ ਭਰ ਦੀ ਜਾਣਕਾਰੀ ਤੱਕ ਪਹੁੰਚਣ ਲਈ ਬਹੁਤ ਆਸਾਨ ਹੈ ਮੈਂ ਸਰਚ ਇੰਜਨ ਡਿਜੀਟਲ ਲਾਈਬਰੇਰੀ ਤੋਂ ਜਾਣਕਾਰੀ ਪ੍ਰਾਪਤ ਕਰਦਾ ਹਾਂ ਇਹ ਜਾਣਕਾਰੀ ਜਲਦੀ ਮਿਲਦੀ ਹੈ ਅਤੇ ਮੈਂ ਕਿਸੇ ਵੀ ਵਿਸ਼ੇ ਬਾਰੇ ਅਪਡੇਟਸ ਕੋ ਜਾਂ ਸ਼ਿਵਲਾਜੇਸ਼ਨ ਇਤਿਹਾਸ ਅਤੇ ਟੈਕਨੋਲਜੀ ਬਾਰੇ ਨਵਾਂ ਗਿਆਨ ਵੀ ਪ੍ਰਾਪਤ ਕਰ ਸਕਦਾ ਹਾਂ ਅਗਰ ਮੈਨੂੰ ਕਿਤੇ ਜਾਨ ਦੀ ਲੋੜ ਪਏ ਤਾਂ ਮੈਂ ਇੰਟਰਨੈਟ ਦੀ ਵਰਤੋਂ ਨਾਲ ਮੈਪਸ ਨਕਸ਼ੇ ਪੜ੍ਹ ਸਕਦਾ ਹਾਂ ਜਿਹਦੇ ਨਾਲ ਇਹਨੂੰ ਆਸਾਨੀ ਹੋਵੇ ਅਤੇ ਮੈਂ ਆਸਾਨੀ ਆ ਆਪਣੀ ਯਾਤਰਾ ਪੂਰੀ ਕਰ ਸਕਾਂ